ਧਾਰਮਿਕ ਸਥਾਨਾਂ 'ਤੇ ਗੁਰਦੁਆਰਿਆਂ ਅੰਦਰ ਕੀਰਤਨ ਪ੍ਰੋਗਰਾਮ ਕਰਵਾਏ ਜਾਂਦੇ ਨੇ ਢਾਡੀ ਵਾਰਾਂ ਗਵਾਈਆਂ ਜਾਂਦੀਆਂ ਨੇ ਢਾਡੀ ਜੱਥੇ ਲਵਾਏ ਜਾਂਦੇ ਨੇ ਅਤੇ ਜਿਹੜੇ ਸਾਨੂੰ ਧਰਮ ਧਾਰਮਿਕ ਹੋਣ ਦਾ ਅਨੁਭਵ ਕਰਵਾਉਂਦੇ ਨੇ ਅਤੇ ਧਰਮ ਦੇ ਇਤਿਹਾਸ ਤੋਂ ਜਾਣੂ ਕਰਵਾਉਂਦੇ ਨੇ ਇਹਨਾਂ ਦੇ ਨਾਲ ਨਾਲ ਲੰਗਰਾਂ ਦੇ ਪ੍ਰਬੰਧ ਵੀ ਕੀਤੇ ਜਾਂਦੇ ਨੇ ਧਾਰਮਿਕ ਸਥਾਨਾਂ 'ਤੇ ਕਹੀਏ ਤਾਂ ਮੰਦਰਾਂ ਦੇ ਵਿੱਚ ਭਜਨ ਗਾਏ ਜਾਂਦੇ ਨੇ ਕੁਝ ਸਮਾਂ ਪਹਿਲਾਂ ਹੀ ਹੁਣੇ ਉਲਾ ਆ ਉਹ ਦੀਵਾਲੀ ਦੁਸ਼ਹਿਰਾ ਲੰਘ ਕੇ ਗਿਆ ਉਸ ਤੋਂ ਪਹਿਲਾਂ ਰਾਮਲੀਲਾ ਦਾ ਆਯੋਜਨ ਕੀਤਾ ਜਾਂਦਾ ਲੋਕ ਤਰ੍ਹਾਂ ਤਰ੍ਹਾਂ ਦੇ ਸੱਭਿਆਚਾਰਿਕ ਪ੍ਰੋਗਰਾਮ ਕਰਦੇ ਨੇ ਚਰਚਾਂ ਦੇ ਵਿੱਚ ਹਰ ਐਤਵਾਰ ਦੀ ਪ੍ਰਾਰਥਨਾ ਸ ਸ ਸਭਾ ਹੁੰਦੀ ਹੈ ਦਰਗਾਹ ਵਿੱਚ ਕਵਾਲੀਆਂ ਗਾਈਆਂ ਜਾਂਦੀਆਂ ਨੇ ਮਸਜਿਦ ਵਿੱਚ ਸਮੂਹਿਕ ਪ੍ਰਾਰਥਨਾਵਾਂ ਹੁੰਦੀਆਂ ਨੇ ਗੁਰਦੁਆਰਿਆਂ ਦੇ ਵਿੱਚ ਕੀਰਤਨ ਦੇ ਨਾਲ ਨਾਲ ਪਾਠ ਵੀ ਕਰਵਾਏ ਜਾਂਦੇ ਨੇ ਪ੍ਰਾਰਥਨਾ ਇਕ ਮੱਠ ਹੈ ਅਤੇ ਪ੍ਰਾਰਥਨਾ ਹਰ ਧਰਮ ਦੇ ਵਿੱਚ ਅਲੱਗ ਅਲੱਗ ਰੂਪਾਂ ਵਿੱਚ ਕੀਤੀ ਜਾਂਦੀ ਹੈ